ਹੈਲੋ ਕੀ ਤੁਸੀਂ ਜਨਮ ਅਤੇ ਮਰਨ ਰਜਿਸਟਰੇਸ਼ਨ ਦਫਤਰ ਤੋਂ ਬੋਲ ਰਹੇ ਹੋ ਮੈਂ ਆਪਣੇ ਬੱਚੇ ਦੀ ਜਨਮ ਰਜਿਸਟਰੇਸ਼ਨ ਬਣਾਉਣ ਲਈ ਆਨਲਾਈਨ ਅਰਜ਼ੀ ਦਿੱਤੀ ਸੀ ਜਿਸ ਦਾ ਜਨਮ ਬਾਈ ਸਤੰਬਰ ਦੋ ਹਜ਼ਾਰ ਚੌਵੀ ਨੂੰ ਫਿਰੋਜ਼ਪੁਰ ਵਿਖੇ ਹੋਇਆ ਸੀਗਾ ਮੈਂ ਜਾਣਨਾ ਚਾਹੁੰਦਾ ਹਾਂ ਕਿ ਜੋ ਪ੍ਰਕਿਰਿਆ ਹੈ ਰਜਿਸਟਰੇਸ਼ਨ ਦੀ ਉਹ ਕਿੱਥੋਂ ਤੱਕ ਪੁੱਜ ਚੁੱਕੀ ਹੈ ਅਤੇ ਮੈਨੂੰ ਕਦੋਂ ਤੱਕ ਉਸਦਾ ਬਰਥ ਸਰਟੀਫਿਕੇਟ ਮਿਲ ਜਾਵੇਗਾ ਕਿਉਂਕਿ ਉਹ ਬਹੁਤ ਥਾਂ ਜ਼ਰੂਰਤਮੰਦ ਹੈ ਇਸ ਕਰਕੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕਦੋਂ ਤੱਕ ਜਿਹੜਾ ਕਿ ਰਜਿਸਟਰੇਸ਼ਨ ਪ੍ਰੋਸੈਸ ਹੈ ਖਤਮ ਹੋ ਜਾਵੇਗਾ ਅਤੇ ਸਾਨੂੰ ਸਾਡੇ ਬੱਚੇ ਦਾ ਜਨਮ ਸਰਟੀਫਿਕੇਟ ਮਿਲ ਜਾਵੇਗਾ